ਹਾਂਜੀ ਸਤਿ ਸ਼੍ਰੀ ਅਕਾਲ ਮੇਰੀ ਗੱਲ ਮਨਪ੍ਰੀਤ ਨਾਲ ਹੋ ਰਹੀ ਹੈ ਹਾਂਜੀ ਮੈਂ ਨਾ ਬਠਿੰਡੇ ਤੋਂ ਹਾਂ ਅਸੀਂ ਨਵੇਂ ਹਾਂ ਅਤੇ ਪਟਿਆਲੇ ਦੇ ਕਲੋਨੀ 'ਚ ਨਵੇਂ ਰਹਿਣ ਆਏ ਹਾਂ ਤੁਹਾਡੇ ਉਰੇ ਅਤੇ ਤੁਹਾਡਾ ਨੰਬਰ ਗੁਆਂਢੀਆ ਨੇ ਦਿੱਤਾ ਸੀ ਤੁਸੀਂ ਮੈਨੂੰ ਆਪਣੇ ਉਰੇ ਕੋਈ ਵਧੀਆ ਮਾਰਕੀਟ ਵਗੈਰਾ ਦੱਸ ਸਕਦੇ ਓਂ ਕਿਹੜੀਆਂ ਹਨ ਹਾਂਜੀ ਮਤਲਬ ਕਿਸ ਤਰ੍ਹਾਂ ਦੇ ਮਾਰਕੀਟ ਵਿੱਚ ਸਮਾਨ ਵਗੈਰਾ ਦੱਸੂਗੇ ਕਿ ਮਤਲਬ ਰੇਟ ਰੇਟ ਵਗੈਰਾ ਵੀ ਨਾਲ ਹਾਂਜੀ ਠੀਕ ਜੀ ਹੋਰ ਠੀਕ ਹੈ ਜੀ ਓਕੇ ਅਤੇ ਮਤਲਬ ਹੋਰ ਕੁਛ ਦੱਸ ਸਕਦੇ ਹੋ ਕਿ ਲਾਈਕ ਰੋਜ਼ ਦੇ ਸਮਾਨ ਲਈ ਅਸੀਂ ਮਤਲਬ ਕਿੱਥੇ ਜਾ ਸਕਦੇ ਕਿਹੜੀ ਮਾਰਕੀਟ ਈਜ਼ੀ ਨੇੜੇ ਪਏਗੀ ਅੱਛਾ ਜੀ ਤੁਸੀਂ ਹਾਂਜੀ ਨਹੀਂ ਫਿਰ ਤਾਂ ਬਹੁਤ ਵਧੀਆ ਤੁਸੀਂ ਮੈਨੂੰ ਦੱਸ ਦੱਸ ਦਿਓ ਮੈਨੂੰ ਇੱਕ ਵਾਰ ਫੋਨ ਕਰ ਦਿਓ ਨਾ ਸ਼ਨੀਵਾਰ ਨੂੰ ਤਾਂ ਕਿ ਆਪਾਂ ਫਿਰ ਦੇਖ ਲਈਏ ਕਿਵੇਂ ਜਾਣਾ ਹੋਵੇਗਾ ਸਾਨੂੰ ਫਿਰ ਇਕੱਠੇ ਹੀ ਚੱਲ ਪਵਾਂਗੇ ਹਾਂਜੀ ਠੀਕ ਹੈ ਜੀ ਅਤੇ ਹੋਰ ਸਮਾਨ ਵਗੈਰਾ ਸਭ ਕੁਝ ਈਜ਼ੀਲੀ ਮਿਲ ਜਾਂਦਾ ਕਾਫੀ ਟਾਈਪ ਜਾਂ ਕੁਛ ਉਹ ਮਹਿੰਗੀਆਂ ਤਾਂ ਨਹੀਂ ਮਿਲਣਗੀਆਂ ਮਤਲਬ ਕੁਆਲਟੀ ਵਧੀਆ ਹੋਣਗੀਆਂ ਹੱਦ ਤੋਂ ਜ਼ਿਆਦਾ ਜਿਵੇਂ ਘਰ ਦੇ ਸਮਾਨ ਜਾਂ ਕੁਛ ਠੀਕ ਹੈ ਜੀ ਫਿਰ ਚਲੋ ਇਹ ਤੁਸੀਂ ਮੈਨੂੰ ਦੱਸ ਦੇਣਾ ਇੱਕ ਵਾਰ ਫੋਨ ਕਰਕੇ ਫਿਰ ਬਹੁਤ ਹੀ ਵਧੀਆ ਹੋਜੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਫਿਰ ਤਾਂ ਬਹੁਤ ਤੁਹਾਡਾ ਹਾਂਜੀ